ਪੰਜਾਬ ਭਾਰਤ ਦਾ ਇੰਡੀਆ ਦਾ ਇੱਕ ਮੋਹਰੀ ਸੂਬਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਦੇ ਵਿੱਚ ਖੋਜਾਂ ਨੂੰ ਲੈ ਕੇ ਨਵੀਂ ਟੈਕਨੋਲਜੀ ਨੂੰ ਲੈ ਕੇ ਅਕਸਰ ਰਿਸਰਚ ਹੁੰਦੀ ਰਹਿੰਦੀ ਆ ਕਾਫ਼ੀ ਸਾਰੀਆਂ ਯੂਨੀਵਰਸਿਟੀਆਂ ਨੇ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ ਤਾਂ ਹਰ ਇੱਕ ਅਲੱਗ ਕਿੱਤੇ ਨੂੰ ਲੈ ਕੇ ਖੇਤੀ ਨੂੰ ਲੈ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਅਦਰ ਰਿਸਰਚ ਨੂੰ ਲੈ ਕੇ ਬਾਕੀ ਯੂਨੀਵਰਸਿਟੀਜ਼ ਨੇ ਠੀਕ ਹੈ ਸਪੋਰਟਸ ਯੂਨੀਵਰਸਿਟੀ ਵੀ ਹੈ ਤਾਂ ਹਰ ਇੱਕ ਫੀਲਡ ਦੇ ਵਿੱਚ ਅਲੱਗ ਅਲੱਗ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿ ਰਿਸਰਚ ਵੀ ਹੁੰਦੀ ਰਹਿੰਦੀ ਆ ਅਪ ਟੂ ਡੇਟ ਰਹਿੰਦੀਆਂ ਨੇ ਤਾਂ ਪੰਜਾਬ ਦੇ ਵਿੱਚ ਨਵੀਨਤਾ ਕੇਂਦਰ ਜਾਂ ਸਿੱਖਿਆ ਨਾਲ਼ ਸੰਬੰਧਿਤ ਖੇਤਰ ਕਾਫ਼ੀ ਨੇ ਜਿਸ ਕਰਕੇ ਐਜੂਕੇਸ਼ਨ ਲੈਵਲ ਦਾ ਜੇਕਰ ਅਸੀਂ ਦੇਖੀਏ ਤਾਂ ਪੰਜਾਬ ਬਾਕੀ ਸਾਰੇ ਸੂਬਿਆਂ ਦੇ ਨਾਲ਼ੋਂ ਵੀ ਤਾਂ ਮਤਲਬ ਬੈਟਰ ਹੈ ਕਾਫ਼ੀ ਅੱਛਾ ਹੈ